ਇੱਥੋਂ ਚਾਲੂ ਕਰਨਾ ਇੱਥੋਂ ਬੰਦ ਕਰਨਾ ਸਤਿ ਸ਼੍ਰੀ ਅਕਾਲ ਸਰ ਦੇਸ਼ ਮੈਂ ਮੈਂ ਦੇਸ਼ ਰਾਜ ਬੋਲਦਾ ਹਾਂ ਰਹਿਣ ਵਾਲਾ ਪਠਾਨਕੋਟ ਪਿੰਡ ਫੂਲ ਚੱਕ ਢੇਸੀਆਂ ਦਾ ਸਾਡੇ ਪੰਜਾਬ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਬਹੁਤ ਹੈ ਸਾਡੇ ਪੰਜਾਬ ਵਿੱਚ ਗਰੀਬੀ ਘਟਾਉਣ ਲਈ ਸਰਕਾਰ ਨੂੰ ਵਧੀਆ ਤੋਂ ਵਧੀਆ ਕੰਮ ਕਰਨੇ ਚਾਹੀਦੇ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੋਈ ਨੌਕਰੀਆਂ ਦੀ ਸਹੂਲਤਾਂ ਦਿੱਤੀਆਂ ਜਾਣ ਜਿਹੜੇ ਪੜ੍ਹੇ ਲਿਖੇ ਬੱਚੇ ਹੈ ਉਹਨਾਂ ਨੂੰ ਸਕੋਲੋਰਸ਼ਿਪ ਦਿੱਤੀਆਂ ਦਿੱਤੀਆਂ ਜਾਂਦੀਆਂ ਅਤੇ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਜਾਂਦਾ ਪਰ ਇਹਨਾਂ ਦੀ ਗਰੀਬੀ ਦੂਰ ਕਰਨ ਲਈ ਕਈਆਂ ਨੂੰ ਐਸੀ ਕੋਟੇ 'ਤੇ ਸ਼ਡਿਉਲ ਕਾਸਟਾਂ ਨੂੰ ਪੈਨਸ਼ਨਾਂ ਲਾਈਆਂ ਜਾਂਦੀਆਂ ਪਰ ਇਹਨਾਂ ਨੂੰ ਜਿਹੜੇ ਵੀ ਸਾਡੇ ਨੂੰ ਜੋ ਪੜ੍ਹੇ ਲਿਖੇ ਬੱਚੇ ਨੇ ਇਹਨਾਂ ਨੂੰ ਗਰੀਬੀ ਦੂਰ ਕਰਨ ਵਾਸਤੇ ਕੋਈ ਵਧੀਆ ਰੁਜ਼ਗਾਰ ਦਿੱਤਾ ਜਾਵੇ ਸਾਡੇ ਪੰਜਾਬ ਦੀ ਬੇਰੁਜ਼ਗਾਰੀ ਤਾਂ ਹੀ ਦੂਰ ਹੋ ਸਕਦੀ ਹੈ ਸਾ